ਜਦੋਂ ਮੈਨੂੰ ਵਧੇਰੇ ਲੋਕਾਂ ਦਾ ਖਾਣਾ ਪਕਾਉਣਾ ਪਿਆ ਤਾਂ ਇਕਦਮ ਮੇ ਮੇਰੇ ਦਿਮਾਗ ਵਿੱਚ ਤਰਕੀਬ ਆਈ ਕਿ ਮੈਂ ਚਾਰ ਚੁੱਲ੍ਹਿਆਂ ਵਾਲੇ ਗੈਸ 'ਤੇ ਖਾਣਾ ਬਣਾਇਆ ਅਤੇ ਇੱਕ 'ਤੇ ਚਾਵਲ ਬਣਾਏ ਇੱਕ 'ਤੇ ਦਾਲ ਬਣਾਈ ਇੱਕ 'ਤੇ ਮੈਂ ਕੜਾਹ ਬਣਾਇਆ ਅਤੇ ਇੱਕ 'ਤੇ ਪ੍ਰਸ਼ਾਦੇ ਬਣਾ ਕੇ ਪ੍ਰਾਹੁਣਿਆਂ ਨੂੰ ਸਰਵ ਕਰਿਆ ਜਿਸ ਕਰਕੇ ਮੇਰੇ ਟਾਈਮ ਦੀ ਬੱਚਤ ਹੋਈ ਅਤੇ ਮੈਂ ਬਹੁਤ ਲੋਕਾਂ ਦਾ ਬਹੁਤ ਲੋਕਾਂ ਨੂੰ ਖਾਣਾ ਬਣਾ ਕੇ ਖਿਲਾਇਆ ਅਤੇ ਇਸ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਖਾਣਾ ਤਿਆਰ ਕੀਤਾ